ਗੌਰਵ ਫੁਟੇਜ ਤੋਂ ਗੱਲ ਕਰ ਰਹੇ ਹੋ ਜੀ ਗੌਰਵ ਜੀ ਪਿਛਲੇ ਦੋ ਦਿਨਾਂ ਤੋਂ ਨਾ ਇੱਕ ਔਡਰ ਕੀਤਾ ਸੀਗਾ ਪਰ ਉਹ ਔਡਰ ਦਾ ਕੀ ਸੀ ਪੇਮੈਂਟ ਵਗੈਰਾ ਮੈਂ ਤੁਹਾਨੂੰ ਕਰਤੀ ਸੀ ਔਨਲਾਈਨ ਗੂਗਲ ਪੇਅ ਕਰਤੇ ਸੀ ਪੈਸੇ ਪਰ ਔਡਰ ਜਿਹੜਾ ਸੀ ਤੁਹਾਡਾ ਮੈਂ ਬੈਕ ਕਰਤਾ ਵਾਪਸੀ ਕਰਤਾ ਸੀਗਾ ਕਿਉਂਕਿ ਉਹ ਜਿਹੜਾ ਤੁਸੀਂ ਮਟੀਰੀਅਲ ਭੇਜਿਆ ਸੀ ਉਹਦੇ ਵਿੱਚ ਉਹ ਸਹੀ ਨਹੀਂ ਸੀਗਾ ਜਿਹਦੇ ਵਿੱਚ ਖਾਣੇ ਦੇ ਸਮਾਨ ਦੇ ਵਿੱਚ ਉਲੀ ਵਗੈਰਾ ਜੰਮੀ ਹੋਈ ਸੀਗੀ ਜਿਹਦੇ ਕਰਕੇ ਉਹ ਆਪਣਾ ਪੁਆਇਜ਼ਨੇਬਲ ਹੋ ਗਿਆ ਸੀਗਾ ਅਤੇ ਮੈਂ ਤੁਹਾਨੂੰ ਵਾਪਸੀ ਭੇਜਤਾ ਸੀਗਾ ਪਰ ਉਹਦਾ ਜਿਹੜਾ ਪੇਮੈਂਟ ਦਾ ਰਿਫੰਡ ਸੀ ਉਹ ਮੈਨੂੰ ਹਾਲੇ ਵਾਪਸੀ ਤੁਹਾਡੇ ਵੱਲੋਂ ਨਹੀਂ ਕੀਤਾ ਗਿਆ ਵੀ ਉਹਦਾ ਮੈਨੂੰ ਇੱਕ ਤਾਂ ਕਾਰਨ ਦੱਸ ਦਿਓ ਅਤੇ ਦੂਜਾ ਇਹ ਦੱਸੋ ਵੀ ਉਹਦੀ ਜਿਹੜੀ ਪੇਮੈਂਟ ਹੈਗੀ ਹੈ ਉਹ ਕਦੋਂ ਰਿਫੰਡ ਕਰੋਗੇ ਜੇ ਤੁਸੀਂ ਆਪਣੇ ਤਰੀਕੇ ਪਿਆਰ ਨਾਲ ਕਰ ਦਿਓਗੇ ਤਾਂ ਆਪਣੇ ਭਾਈ ਬੰਦੀ ਆ ਜਿਹੜੀ ਉਹ ਬਣੀ ਰਹੇਗੀ ਜੇ ਉਹਦੇ ਵਿੱਚ ਫਿਰ ਕੋਈ ਦਿੱਕਤ ਆਉਂਦੀ ਹੈ ਤਾਂ ਕੱਲ੍ਹ ਨੂੰ ਫਿਰ ਆਪਣਾ ਦੋਨਾਂ ਭਰਾਵਾਂ ਦਾ ਚੱਕਰ ਪਏਗਾ ਰਿੜ ਪਏਗੀ ਲੜਾਈ ਦੇ ਚਾਂਸਸ ਵੱਧ ਜਾਣਗੇ ਸੋ ਮੈਂ ਤੁਹਾਨੂੰ ਕਹਿੰਦਾ ਵੀ ਆਪਣਾ ਜਿਹੜਾ ਵੀ ਇਹ ਇਸ਼ੂ ਹੈਗਾ ਰਿਫੰਡ ਦੇ ਰਿਗਾਰਡਿੰਗ ਜੋ ਮੈਂ ਤੁਹਾਨੂੰ ਪੇਮੈਂਟ ਕੀਤੀ ਹੈ ਖਾਣੇ ਦੀ ਔਡਰ ਦੀ ਉਹ ਮੈਨੂੰ ਰਿਫੰਡ ਕਰ ਦਿਓ ਜਿਹਦੇ ਕਰਕੇ ਵੀ ਆਪਣਾ ਦੋਨਾਂ ਭਰਾਵਾਂ ਦੇ ਵਿੱਚ ਜਿਹੜਾ ਪ੍ਰੇਮ ਪਿਆਰ ਆ ਉਹ ਬਣਿਆ ਰਹੇ ਕਿਸੇ ਤਰ੍ਹਾਂ ਤਾਂ ਆਪਾਂ ਦੋਨਾਂ ਨੂੰ ਦਿੱਕਤ ਨਾ ਹੋਵੇ